ਹੈਲੋ ਸਰ ਐਮਰਜੈਂਸੀ ਟ ਸਰਵਿਸਿਸ ਤੋਂ ਬੋਲਦੇ ਹੈਗੇ ਇੱਥੇ ਸਾਡੇ ਰੇਲਵੇ ਸਟੇਸ਼ਨ ਹੈਗੇ ਇੱਥੇ ਮਗਰ ਨਾ ਇੱਕ ਆਦਮੀ ਹੈਗੇ ਕਾਫ਼ੀ ਜਖਮੀ ਹੋ ਗਿਆ ਪਲੀਜ ਤੁਸੀਂ ਇੱਥੇ ਜਲਦੀ ਤੋਂ ਜਲਦੀ ਆ ਸਕਦੇ ਹਾਂ ਤਾਂ ਜੋ ਉਹਨਾਂ ਦਾ ਇਲਾਜ ਕੀਤਾ ਜਾ ਸਕੇ ਅਸੀਂ ਮੁਕਤਸਰ ਦੇ ਮੁਕਸਰ ਜ਼ਿਲ੍ਹੇ ਤੋਂ ਬਾਹਰ ਬਾਹਰ ਕਾਲਜ ਦੇ ਮਗਰਲੀ ਸਾਈਡ ਜੋ ਰੇਲਵੇ ਸਟੇਸ਼ਨ ਹੈਗੇ ਆ ਉੱਥੇ ਇੱਕ ਐਕਸੀਡੈਂਟ ਹੋਇਆ ਹੈ ਅਤੇ ਉੱਥੇ ਐਮਰਜੈਂਸੀ ਕੇਸ ਹੈ ਜਿਸ ਕਰਕੇ ਐਮਰਜੈਂਸੀ ਮੈਡੀਕਲ ਦੀ ਸਖਤ ਤੋਂ ਸਖਤ ਲੋੜ ਹੈ ਕੀ ਤੁਸੀਂ ਇੱਥੇ ਆਕੇ ਉਸ ਇਨਸਾਨ ਦੀ ਹੈਲਪ ਕਰ ਸਕਦੇ ਹੈ ਤਾਂ ਜੋ ਉਸ ਦੀ ਜਾਨ ਨੂੰ ਬਚਾਇਆ ਜਾ ਸਕੇ ਕਿਉਂਕਿ ਉਸ ਦੇ ਕਾਫ਼ੀ ਜ਼ਿਆਦਾ ਸੱਟਾਂ ਲੱਗੀਆਂ ਹੋਈਆ ਹਨ ਅਤੇ ਉਸ ਦੇ ਕਾਫ਼ੀ ਨੁਕਸਾਨ ਹੋਇਆ ਹੋਇਆ ਹੈ ਸਰੀਰ ਦੇ ਵਿੱਚੋਂ ਕਈ ਥਾਵਾਂ ਤੋਂ ਉਸਦੇ ਖੂਨ ਵਗੈਰਾ ਨਿਕਲ ਰਿਹਾ ਹੈ ਜਿਸ ਕਰਕੇ ਉਸਨੂੰ ਕਾਫ਼ੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਲੀਜ਼ ਕਿਰਪਾ ਕਰਕੇ ਤੁਸੀਂ ਇੱਥੋਂ ਜਲਦੀ ਤੋਂ ਜਲਦੀ ਪਹੁੰਚਣ ਦੀ ਕਿਰਪਾਲਤਾ ਕਰੋ